ਲੰਬੀ ਬਾਈਕਿੰਗ ਯਾਤਰਾ ਦੀ ਤਿਆਰੀ ਲਈ ਕੁਝ ਮਹੱਤਵਪੂਰਨ ਚੀਜ਼ਾਂ ਜਿਹੜੀਆਂ ਅਸੀਂ ਨਾਲ ਲੈ ਕੇ ਜਾ ਸਕਦੇ ਹਾਂ ਜਿਵੇਂ ਹੈਲਮਟ ਹੋ ਗਿਆ ਗਲਵਸ ਹੋ ਗਏ ਜੈਕਟ ਹੋ ਗਈ ਹੋਰ ਜਿਹੜੀਆਂ ਸਾਨੂੰ ਜ਼ਰੂਰਤ ਵਾਲੀ ਲੋੜਾਂ ਦੀਆਂ ਚੀਜ਼ਾਂ ਉਹ ਲੈ ਕੇ ਜਾ ਸਕਦੇ ਹਾਂ ਹੋਰ ਬਾਈਕ ਦੀ ਜਿਹੜੀ ਜਿਹੜੀ ਹਾਲਤ ਹੈ ਉਹ ਠੀਕ ਹੋਣੀ ਚਾਹੀਦੀ ਆ ਹੋਰ ਮੈਪ ਦੇ ਨੈਵੀਗੇਸ਼ਨ ਉਪਕਰਨ ਲੈ ਕੇ ਜਾਣੇ ਚਾਹੀਦੇ ਹੈ ਲੰਬੀ ਯਾਤਰਾ ਦੌਰਾਨ ਸਾਨੂੰ ਜਿਹੜਾ ਪੂਰਨ ਅਤੇ ਪ੍ਰੋਟੀਨ ਯੁਕਤ ਜਿਹੜਾ ਵਾ ਖੁਰਾਕ ਲੈ ਕੇ ਜਾਣੀ ਚਾਹੀਦੀ ਹੈ ਅਤੇ ਆਪਣੀ ਯਾਤਰਾ ਰੂਟ ਜਿਹੜੀ ਆ ਉਹ ਸਾਨੂੰ ਪਹਿਲਾਂ ਪ੍ਰੀ ਪਲੈਨ ਕਰ ਲੈਣੀ ਚਾਹੀਦੀ ਹੈ ਅਤੇ ਜਿਹੜੀਆਂ ਸਾਨੂੰ ਸਮੱਸਿਆ ਆਉਣੀਆਂ ਉਹਦੇ ਲਈ ਤਿਆਰ ਰਹਿਣਾ ਚਾਹੀਦੀਆਂ ਜਿਵੇਂ ਰਸਤੇ ਵਿੱਚ ਕਈ ਵਾਰੀ ਬਾਰਿਸ਼ ਆ ਜਾਂਦੀ ਆ ਉਹਦੇ ਲਈ ਸਾਨੂੰ ਰੇਨਕੋਟ ਔਰ ਟੈਂਟ ਹਾਊਸ ਵਗੈਰਾ ਜਿਹੜਾ ਨਾਲ ਲੈ ਕੇ ਜਾਣਾ ਚਾਹੀਦਾ ਅਤੇ ਗਰਮੀਆਂ ਲਈ ਜਿਹੜਾ ਸ਼ਰਬਤ ਅਤੇ ਹੋਰ ਠੰਡੀਆਂ ਚੀਜ਼ਾਂ ਵੀ ਨਾਲ ਲੈ ਕੇ ਜਾਣੀਆ ਚਾਹੀਦੀਆਂ ਅਤੇ ਮਤਲਬ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਮੌਸਮ ਅਤੇ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਚੀਜ਼ਾਂ ਨਾਲ ਲੈ ਕੇ ਜਾਣੀਆ ਜ਼ਰੂਰੀ ਚਾਹੀਦੀਆਂ ਹਨ ਧੰਨਵਾਦ